ਹੈਲੋ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੋ ਕਿ ਅੱਜ ਮੈਂ ਪਸ਼ੂਆਂ ਤੋਂ ਮਾਲੀਆ ਤਿਆਰ ਕਰਨ ਜਾਂ ਪੈਦਾ ਕਰਨ ਲਈ ਦੱਸਣਾ ਚਾਹੁੰਦਾ ਹਾਂ ਜਿਵੇਂ ਕਿ ਪੁਰਾਣੇ ਸਮਿਆਂ ਵਿੱਚ ਲੋਕ ਊਠਾਂ ਤੋਂ ਕਰਵਾਇਆ ਵਾਹ ਕੇ ਜਾਂ ਉਹਨਾਂ ਦੀ ਬਰੀਡ ਤਿਆਰ ਕਰਕੇ ਅੱਗੇ ਬੱਚੇ ਤਿਆਰ ਕਰਕੇ ਉਹਨਾਂ ਨੂੰ ਸੇਲ ਕਰ ਦਿੰਦੇ ਸੀਗੇ ਤਾਂ ਉਹਨਾਂ ਤੋਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮੁਨਾਫਾ ਹੁੰਦਾ ਸੀ ਜਾਂ ਮਾਲੀਆ ਹੁੰਦਾ ਸੀਗਾ ਜਿਵੇਂ ਕਿ ਅੱਜ ਕੱਲ੍ਹ ਬਲਦਾਂ ਬਲਦਾਂ ਤੋਂ ਖੇਤਾਂ ਦੇ ਵਿੱਚ ਕੰਮ ਕਰਵਾਇਆ ਜਾਂਦਾ ਹੈ ਕਿਸਾਨੀ ਤੌਰ 'ਤੇ ਵੀ ਅਤੇ ਉਸ ਤੋਂ ਮਾਲੀਆ ਤਿਆਰ ਕੀਤਾ ਜਾਂਦਾ ਹੈ ਅਤੇ ਅਗਾਂਹ ਵੀ ਬੱਚੇ ਤਿਆਰ ਕੀਤੇ ਜਾਂਦੇ ਹਨ ਬਲਦਾਂ ਤੋਂ ਘੋੜਿਆਂ ਤੋਂ ਅਸੀਂ ਚੰਗੀ ਬਰੀਡ ਤਿਆਰ ਕਰ ਸਕਦੇ ਹਾਂ ਅਤੇ ਬਰੀਡ ਚੰਗੀ ਤਿਆਰ ਹੋਣ ਦੇ ਕਾਰਣ ਸਾਡੇ ਬਰੀਡ ਬਹੁਤ ਹੀ ਜ਼ਿਆਦਾ ਬਿਕਰੀ ਹੁੰਦੀ ਹੈ ਅਤੇ ਬਹੁਤ ਹੀ ਜ਼ਿਆਦਾ ਬਰੀਡ ਵਿਕਦੀ ਹੈ ਕਿ ਜਿਸ ਤੋਂ ਸਾਨੂੰ ਬਹੁਤ ਹੀ ਚੰਗਾ ਮਾਲੀਆ ਪਿਆ ਮਿਲਦਾ ਹੈ ਅਤੇ ਚੰਗਾ ਮਾਲੀਆ ਮਿਲਣ ਦੇ ਕਾਰਣ ਅਸੀਂ ਜੇ ਸਾਡੇ ਕੋਲ ਚੰਗੇ ਪੈਸੇ ਹੋਣਗੇ ਤਾਂ ਅਸੀਂ ਹੋਰ ਚੰਗੀ ਤੋਂ ਚੰਗੀ ਬਰੀਡ ਖਰੀਦ ਕੇ ਅਤੇ ਉਹਦੇ ਬੱਚੇ ਤਿਆਰ ਕਰਕੇ ਅਗਾਂਹ ਹੋਰ ਚੰਗੀ ਬਰੀਡ ਖਰੀਦ ਕੇ ਐਂ ਸਰਕਲ ਚੱਲੀ ਜਾਂਦਾ ਰਹਿੰਦਾ ਹੈ ਅਤੇ ਅਸੀਂ ਪਸ਼ੂਆਂ ਜਿਵੇਂ ਕਿ ਅਸੀਂ ਗਾਵਾਂ ਮੱਝਾਂ ਘਰੇ ਘਰ ਵਿੱਚ ਰੱਖ ਕੇ ਉਹਨਾਂ ਨੂੰ ਚੰਗਾ ਹਰਾ ਚਾਰਾ ਖੁਰਾਕ ਫੀਡ ਪਾ ਕੇ ਅਤੇ ਉਹਨਾਂ ਤੋਂ ਉਹਨਾਂ ਦਾ ਗੋਬਰ ਵੇਚਦੇ ਹਾਂ ਜਾਂ ਕਿ ਉਹਨਾਂ ਤੋਂ ਅਸੀਂ ਉਹਨਾਂ ਦਾ ਦੁੱਧ ਚੋ ਕੇ ਵੇਚਦੇ ਹਾਂ ਜਿਸ ਵਿੱਚੋਂ ਸਾਨੂੰ ਬਹੁਤ ਹੀ ਜ਼ਿਆਦਾ ਮੁਨਾਫਾ ਮਿਲਦਾ ਹੈ ਅਤੇ ਸਾਨੂੰ ਮਾਲੀਆ ਮਿਲਦਾ ਹੈ ਇਸ ਲਈ ਵਾ ਮੈਂ ਇੰਨਾ ਹੀ ਬੋਲਣਾ ਚਾਹੁੰਦਾ ਕਿ ਪੰਜਾਬ ਦੇ ਜਾਂ ਅਸੀਂ ਇਸ ਲਈ ਪਸ਼ੂਆਂ ਤੋਂ ਮਾਲੀਆ ਤਿਆਰ ਕਰ ਸਕਦੇ ਹਾਂ ਧੰਨਵਾਦ